ਅਸੀਂ ਪਿੰਡ ਝੁੰਬਾ ਜ਼ਿਲ੍ਹਾ ਬਠਿੰਡਾ ਵਿੱਚ ਜੋ ਕਿ ਸੇਵਾਵਾਂ ਭਲਾਈ ਕਲੱਬ ਦੇ ਅਧੀਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਜਿਸਟਰ ਕਰਵਾਇਆ ਸੀ ਜਿਸ ਕਲੱਬ ਨੇ ਪਿੰਡ ਵਿੱਚ ਲਾਇਬਰੇਰੀ ਬਣਾਈ ਅਤੇ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਜੋ ਵੀ ਪਿੰਡ ਵਿੱਚ ਪਾਣੀ ਖੜ੍ਹਾ ਸੀ ਉੱਥੇ ਮਿੱਟੀ ਪਾਈ ਪਿੰਡ ਦੇ ਹੋਰ ਬਹੁਤ ਸਾਰੇ ਲੋੜੀ ਲੋੜਵੰਦ ਕੰਮ ਕੀਤੇ ਬੱਸ ਅੱਡਿਆਂ ਦੀ ਸਫ਼ਾਈ ਕੀਤੀ ਅਤੇ ਪਾਰਕ ਤਿਆਰ ਕੀਤਾ ਗਿਆ ਜੋ ਕਿ ਬਹੁਤ ਸਾਫ਼ ਸੁਥਰਾ ਹੈ ਅਤੇ ਲੋਕ ਸ਼ਾਮ ਨੂੰ ਉਸ ਪਾਰਕ ਵਿੱਚ ਸੈਰ ਕਰਨ ਆਉਂਦੇ ਹਨ ਸੁਬਹਾ ਸਵੇਰੇ ਸਵੇਰੇ ਜਿਸ ਵਿੱਚ ਤਾਜ਼ੀ ਹਵਾ ਦਾ ਆਨੰਦ ਮਾਣਦੇ ਹਨ ਸਾਰੇ ਨੌਜਵਾਨ ਇਕੱਠੇ ਹੋ ਕੇ ਪਿੰਡ ਦੇ ਵਿੱਚ ਖੇਡ ਮੇਲੇ ਕਰਵਾਏ ਗਏ ਜਿਸ ਨਾਲ ਲੋਕਾਂ ਨੂੰ ਨਸ਼ਿਆਂ ਤੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਿਆ ਗਿਆ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ ਜੋ ਕਿ ਸੇਵਾਵਾਂ ਭਲਾਈ ਕਲੱਬ ਨੇ ਸਾਡੇ ਸ਼ਹੀਦ ਭਗਤ ਸਿੰਘ ਕਲੱਬ ਨੂੰ ਦੋ ਤਿੰਨ ਵਾਰ ਸਨਮਾਨਿਤ ਵੀ ਕੀਤਾ ਜਿਸ ਨੇ ਲਾਇ ਲਾਇਬਰੇਰੀ ਬਣਾਈ ਲਾਇਬਰੇਰੀ ਦੇ ਵਿੱਚ ਲੋਕ ਅਖ਼ਬਾਰ ਪੜ੍ਹਦੇ ਸਨ ਅਤੇ ਬਜ਼ੁਰਗ ਕਿਤਾਬਾਂ ਪੜ੍ਹ ਕੇ ਆਪਣਾ ਸਮਾਂ ਬਤੀਤ ਕਰਦੇ ਹਨ ਸ ਸਾਡੇ ਪਿੰਡ ਦੇ ਬਸ ਸਟੈਂਡ ਬਸ ਅੱਡਿਆ ਅਤੇ ਸਾਰੀਆਂ ਸਰਕਾਰੀ ਥਾਵਾਂ 'ਤੇ ਰੰਗ ਕੀਤਾ ਗਿਆ ਨੌਜਵਾਨਾਂ ਵੱਲੋਂ ਪਿੰਡ ਨੂੰ ਸੋਹਣਾ ਅਤੇ ਸਾਫ਼ ਸੁਥਰਾ ਬਣਾਇਆ ਗਿਆ ਸਾਡੇ ਕਲੱਬ ਦੀ ਪਿੰਡ ਨੂੰ ਬਹੁਤ ਵੱਡੀ ਦੇਣ ਹੈ ਅਤੇ ਮੈਂ ਚਾਹੁੰਦਾ ਹਾਂ ਸਾਡਾ ਕਲੱਬ ਇਸ ਤਰ੍ਹਾਂ ਹੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਲੋਕਾਂ ਦਾ ਇਕੱਠ ਬਣਿਆ ਰਹੇ ਵਿਸ਼ਵਾਸ ਬਣਿਆ ਰਹੇ ਅਤੇ ਮੇਰੇ ਪਿੰਡ ਦੀ ਸਾਫ਼ ਸਫਾਈ ਇਸ ਤਰ੍ਹਾਂ ਹੀ ਚੱਲਦੀ ਰਹੇ